ਦੇਖੋ ਜੀ ਪੰਜਾਬੀ ਭਾਸ਼ਾ ਨੇ ਕੋਈ ਵੀ ਭਾਸ਼ਾ ਨੂੰ ਪ੍ਰਭਾਵਿਤ ਨਹੀਂ ਕਰਿਆ ਹੈਗਾ ਇਹ ਤਾਂ ਸਮਕਾ ਆਪ ਦਿਨ ਪਰ ਦਿਨ ਘੱਟਦੀ ਜਾ ਰਹੀ ਹੈ ਜੀ ਜਿਵੇਂ ਕੀ ਅੱਜ ਕੱਲ੍ਹ ਲੋਕ ਮੋਡਰਨ ਬਣਦੇ ਜਾਨੇ ਆ ਅਤੇ ਅੰਗਰੇਜ਼ੀ ਹਿੰਦੀ ਨੂੰ ਬੋਲਣਾ ਜਿਆਦਾ ਪ੍ਰੈਫਰ ਕਰਦੇ ਆ ਕਿਉਂਕੀ ਜੀ ਪੰਜਾਬੀ ਸਿਰਫ਼ ਪੰਜਾਬ ਤੱਕਰ ਹੈ ਸੀਮਿਤ ਹੈ ਜਦੋਂ ਆਪਾਂ ਆਊਟ ਔਫ ਸਿਟੀ ਜਾਨੇ ਹਾਂ ਲੋਕ ਇਸਨੂੰ ਬੋਲਣ 'ਚ ਝਿਜਕਦੇ ਹੈ ਵੀ ਲੋਕ ਸਾਨੂੰ ਅਨਪੜ੍ਹ ਕਹਿਣਗੇ ਜਦ ਕੀ ਇਹ ਆਪਣੀ ਮਦਰਟੰਗ ਹੈ ਠੀਕ ਹੈ ਇਹ ਸਾਨੂੰ ਹੋਰ ਸਟੇਟ 'ਚ ਵੀ ਜਾ ਕੇ ਬੋਲਣੀ ਚਾਹੀਦੀ ਹੈ ਜਿਸ ਨਾਲ਼ ਕੀ ਸਾਡੀ ਬੋਲੀ ਬਾਰੇ ਅਤੇ ਸਾਡੇ ਕਲਚਰ 'ਤੇ ਸਾਡਾ ਪਤਾ ਲੱਗੁਗਾ ਵੀ ਅਸੀਂ ਕਿਸ ਸਟੇਟ 'ਤੇ ਆਏ ਹੈ ਇਸ ਨਾਲ਼ ਕੀ ਸਾਡੀ ਭਾਸ਼ਾ ਬਹੁਤ ਹੀ ਅੱਪ ਦਰਜੇ 'ਤੇ ਜਾਊਗੀ ਅਤੇ ਜੋ ਲੋਕ ਅੰਗਰੇਜ਼ੀ ਨੂੰ ਪ੍ਰੈਫ਼ਰੈਂਸ ਦਿੰਦੇ ਨੇ ਓਹ ਥੋੜਾ ਜਾ ਇਸ ਚੀਜ਼ ਤੋਂ ਥੱਲੇ ਆਉਣਗੇ ਕੀ ਜੋ ਬੰਦਾ ਪੰਜਾਬੀ ਬੋਲਦਾ ਹਰ ਬੰਦਾ ਅਨਪੜ੍ਹ ਨੀ ਹੁੰਦਾ ਅਤੇ ਨਾ ਹੀ ਅਨਐਜੂਕੇਟਡ ਹੁੰਦਾ ਅਤੇ ਇਸ ਨਾਲ਼ ਬਹੁਤ ਜ਼ਿਆਦਾ ਫ਼ਰਕ ਪੈ ਰਿਹਾ ਹੈ ਦਿਨ ਪਰ ਦਿਨ ਥੈਂਕ ਯੂ ਧੰਨਵਾਦ ਜੀ